ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਜੋ ਮੈਂ ਤੁਹਾਨੂੰ ਐਡਰੈੱਸ ਦਿੱਤਾ ਤੁਸੀਂ ਉੱਥੇ ਪਹੁੰਚ ਗਏ ਹੋ ਨਹੀਂ ਨਹੀਂ ਉੱਥੇ ਨਹੀਂ ਪੁੱਜਣਾ ਤੁਸੀਂ ਏਦਾਂ ਕਰੋ ਤੁਸੀਂ ਜਿੱਥੇ ਪੁੱਜੇ ਹੋ ਉਹਦੇ ਤੋਂ ਥੋੜ੍ਹਾ ਹੋਰ ਅੱਗੇ ਆ ਜਾਉ ਕ੍ਰਿਸ਼ਨਾ ਮੰਦਰ ਕੋਲ ਉੱਥੇ ਹੀ ਇੱਕ ਦਰਖ਼ਤ ਹੋਏਗਾ ਅਸੀਂ ਉੱਥੇ ਖੜ੍ਹੇ ਹਾਂ ਤੁਸੀਂ ਉੱਥੇ ਤੋਂ ਸਾਨੂੰ ਲੈ ਜਾਉ ਹਾਂਜੀ ਧੰਨਵਾਦ